ਵੀਹ ਹਜ਼ਾਰ ਅੱਠ ਸੌ ਚਾਰ ਹਜ਼ਾਰ ਨੌ ਸੌ ਪੰਜ ਹਜ਼ਾਰ ਛੇ ਸੌ ਸੱਤ ਹਜ਼ਾਰ ਦੋ ਸੌ ਨੌ ਹਜ਼ਾਰ ਅੱਠ ਸੌ